ਖਾਣ ਵਾਲੀਆਂ ਵਸਤਾਂ ਦੇ ਨਾਮ ਆਲੂ ਪਰਾਂਠਾ ਗੋਭੀ ਪਰੌਂਠਾ ਮੇਥੀ ਵਾਲੀ ਰੋਟੀ ਨਾਨ ਛੋਲੇ ਕੁਲਚੇ ਛੋਲੇ ਛੋਲੇ ਭਟੂਰੇ ਭੁੱਜੇ ਛੋਲੇ ਕਾਲੇ ਛੋਲੇ ਚਿੱਟੇ ਛੋਲੇ ਪੰਜੀਰੀ ਮਾਂਹ ਦੀ ਦਾਲ ਛੋਲਿਆਂ ਦੀ ਦਾਲ ਮੁੰਗੀ ਧੋਤੀ ਦਾਲ ਮੁੰਗੀ ਮਸਰੀ ਦਾਲ ਮੁੰਗੀ ਸਾਬਤ ਦਾਲ ਆਲੂ ਮੇਥੀ ਆਲੂ ਗੋਭੀ ਆਲੂ ਮਟਰ ਬੈਂਗਣ ਪੜਥਾ ਜਲੇਬੀ ਗੁਲਾਬ ਜਾਮਣ ਬਰਫੀ ਰਸਗੁੱਲੇ ਸਮੋਸੇ ਮੱਠੀ ਮਟਰ ਲੱਸੀ ਚਾਹ ਫਲਾਂ ਦਾ ਰਸ ਪਨੀਰ ਭੁਰਜੀ ਮਟਰ ਪਨੀਰ